ਮੈਂ ਕਦੇ ਵੀ ਕਿਸੇ ਸਟੇਪਾਂ ਸਿੱਕਿਆਂ ਜਾਂ ਪੱਥਰਾਂ ਦੇ ਕਲੈਕਟਰ ਲਈ ਕਿਸੇ ਵੀ ਕਲੱਬ ਜਾਂ ਸੰਗਠਨ ਵਿੱਚ ਸ਼ਾਮਿਲ ਨਹੀਂ ਹੋਈ ਬਟ ਮੈਨੂੰ ਖੁਦ ਨੂੰ ਪੱਥਰਾਂ ਅਲੱਗ ਅਲੱਗ ਤਰ੍ਹਾਂ ਦੀਆਂ ਇਕੱਠੇ ਕਰਨ ਦਾ ਸ਼ੌਂਕ ਹੈ ਅਤੇ ਮੈਨੂੰ ਉਹ ਇੱਕ ਇੱਕ ਕਲਾ ਦਾ ਕਹਿ ਸਕਦੇ ਹਾਂ ਨਾ ਕਲਾ ਨੂੰ ਇਕੱਠਾ ਕਰਕੇ ਰੱਖਣਾ ਮੈਨੂੰ ਉਹ ਅੱਛਾ ਲੱਗਦਾ ਹੈ ਤਾਂ ਮੈਂ ਉਹ ਖੁਦ ਕਰਦੀ ਹਾਂ ਅਲੱਗ ਅਲੱਗ ਆਕਾਰ ਦੀਆਂ ਅਲੱਗ ਆਕਾਰ ਦੇ ਪੱਥਰ ਅਲੱਗ ਅਲੱਗ ਪੱਥਰਾਂ ਨੂੰ ਜੋੜ ਜੋੜ ਕੇ ਇੱਕ ਇੱਕ ਆਰਟ ਵਰਕ ਕਰਨਾ ਮੈਨੂੰ ਉਹ ਪਸੰਦ ਹੈ ਅਤੇ ਮੈਂ ਉਹ ਪੱਥਰ ਕਲੈਕਟ ਕਰਦੀ ਹਾਂ ਸੋਹਣੇ ਸੋਹਣੇ ਪੱਥਰਾਂ ਨੂੰ ਕਲੈਕਟ ਕਰਕੇ ਅਤੇ ਇੱਕ ਆਰਟ ਵਰਕ ਦੇ ਵਿੱਚ ਉਹਨੂੰ ਬਦਲਦੀ ਹਾਂ